ਹੈਲੋ ਹਾਂਜੀ ਕੀ ਮੇਰੀ ਮੋਹਾਲੀ ਟਰੈਵਲਰ ਏਜੰਸੀ ਨਾਲ ਗੱਲ ਹੋ ਰਹੀ ਆ

ਕੀ ਸਰ ਤੁਸੀਂ ਮੈਨੂੰ ਦੱਸ ਸਕਦੇ ਹੋ ਇੱਥੇ ਘੁੰਮਣ ਵਾਲੀਆਂ ਕੀ ਕੀ ਜਗ੍ਹਾ ਹੁੰਦੀਆਂ ਸਰ ਇਲਾਂਟੇ ਮੋਲ 'ਚ ਅਜਿਹਾ ਕੀ ਕੀ ਹੈ ਡਿਫਰੈਂਟ ਦੇਖਣ ਨੂੰ ਜਿੱਥੇ ਜਾ ਕੇ ਮੈਂ ਟਰੈਵਲ ਕਰ ਸਕਦੀ ਹਾਂ ਕੀ ਸਰ ਇਲਾਂਟੇ ਮੋਲ ਦਾ ਫੂਡ ਵਧੀਆ ਏ ਆ ਓਕੇ ਓਕੇ ਸਰ ਕੀ ਇੱਥੇ ਫੂਡ ਦੀ ਵਿਵਸਥਾ ਹੈਗੀ ਆ ਕੀ ਉੱਥੇ ਫੂਡ ਦੀ ਵਿਵਸਥਾ ਹੈਗੀ ਆ ਸਰ ਹਾਂਜੀ ਓਕੇ ਥੈਂਕ ਯੂ ਸਰ ਮੈਂ ਇਹੀ ਕਨਫਮ ਕਰਨਾ ਸੀਗਾ ਕਿ ਘੁੰਮਣ ਫਿਰਨ ਲਈ ਕੀ ਕੀ ਇੰਮਪੋਰਟੈਂਟ ਆ ਥੈਂਕ ਯੂ ਸੋ ਮੱਚ ਸਰ